ਇੱਕ ਪੁਰਾਣੇ ਸਮੇਂ ਦੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਸੀ ਉਹ ਇੱਕ ਅਲੱਗ ਤਰੀਕੇ ਦੀਆਂ ਹੁੰਦੀਆਂ ਸੀ ਕਿਉਂਕਿ ਉਹ ਜਿਹੜੇ ਕੈਮਰੇ ਹੁੰਦੇ ਸੀ ਉਹ ਰੀਲ ਵਾਲੇ ਕੈਮਰੇ ਹੁੰਦੇ ਸੀਗੇ ਉਹਨਾਂ ਦੇ ਵਿੱਚ ਜਿਵੇਂ ਫੋਟੋ ਕਲਿੱਕ ਕਰਨੀ ਤਾਂ ਉਹ ਰੀਲ ਨੂੰ ਲੈ ਕੇ ਜਾਂਦੇ ਸਟੂਡੀਓ ਅਤੇ ਜਿੱਥੇ ਫੋਟੋ ਤਿਆਰ ਹੁੰਦੀ ਸੀਗੀ ਉੱਥੇ ਫਿਰ ਉਹ ਫੋਟੋ ਨੂੰ ਧਵਾਉਂਦੇ ਹੈ ਨਾ ਅਤੇ ਫੋਟੋ ਨੂੰ ਧਵਾਉਣ ਤੋਂ ਬਾਅਦ ਵੀ ਦੋ ਤਿੰਨ ਦਿਨ ਜਿਹੜੀ ਕਿ ਛੋਟੀ ਤੋਂ ਛੋਟੀ ਫੋਟੋ ਨੂੰ ਵੀ ਲੱਗ ਜਾਂਦੇ ਸੀ ਦੋ ਦਿਨ ਵੀ ਦੂਸਰੇ ਦਿਨ ਆਉਂਦੀ ਜਾਂ ਤੀਸਰੇ ਦਿਨ ਫੋਟੋ ਮਿਲਦੀ ਅਤੇ ਇਸ ਕਰਕੇ ਵੀ ਜਿਹੜੇ ਉਹ ਕੈਮਰੇ ਸ ਵੀ ਆਮ ਕੈਮਰੇ ਹੁੰਦੇ ਸੀਗੇ ਜ਼ਿਆਦਾ ਡਿਜੀਟਲ ਕੈਮਰੇ ਨਹੀਂ ਸੀਗੇ ਫੋਟੋ ਵੀ ਦੋ ਤਿੰਨ ਦਿਨਾਂ 'ਚ ਤਿਆਰ ਹੁੰਦੀ ਸੀ ਪਰ ਅੱਜ ਕੱਲ ਦਾ ਜਿਹੜਾ ਯੁੱਗ ਹੈ ਨਵੀਆਂ ਫੋਟੋਆਂ ਦਾ ਉਹ ਪੁਰਾਣੀਆਂ ਫੋਟੋਆਂ ਨਾਲੋਂ ਕਾਫੀ ਅਲੱਗ ਹੈ ਅਲੱਗ ਇਸ ਤਰ੍ਹਾਂ ਗਾ ਵੀ ਹੁਣ ਜਿਵੇਂ ਨਵੀਆਂ ਫੋਟੋਆਂ ਨੇ ਜੇ ਆਪਾਂ ਫੋਟੋ ਹੁਣ ਖਿਚਾਉਂਦੇ ਹਾਂ ਗਾ ਪਹਿਲੀ ਗੱਲ ਤਾਂ ਉਹ ਚਿੱਪ ਸਿਸਟਮ ਹੈ ਕੈਮਰੇ ਦੇ ਵਿੱਚ ਚਿੱਪ ਜਾਂ ਪੈੱਨ ਡਰਾਈਵ ਪੈਂਦੀ ਹੈ ਫੋਟੋ ਖਿੱਚੀ ਪੰਜ ਮਿੰਟਾਂ 'ਚ ਤੁਹਾਨੂੰ ਫੋਟੋ ਤਿਆਰ ਕਰਕੇ ਦੇ ਦਿੰਦੇ ਨੇ ਗੇ ਕਿਸੇ ਵੀ ਤਰ੍ਹਾਂ ਦੀ ਫੋਟੋ ਤਿਆਰ ਕਰਵਾਓ ਤੁਹਾਨੂੰ ਪੰਜ ਮਿੰਟਾਂ 'ਚ ਫੋਟੋ ਤਿਆਰ ਕਰੋ ਉਹਨਾਂ ਨਾਲੋਂ ਕੈਮਰੇ ਵੀ ਮਹਿੰਗੇ ਨੇ ਡਿਜੀਟਲ ਕੈਮਰੇ ਨੇ ਸਫਾਈ ਜ਼ਿਆਦਾ ਆ ਗਈ ਹੈ ਨਾ ਦੇਖਣ 'ਚ ਜਿਹੜੇ ਕਿ ਸਫਾਈ ਕਾਫੀ ਹੈਗੀ ਵੀ ਕਾਫੀ ਜਿੰਨਾ ਵੀ ਜ਼ੂਮ ਕਰੋਂਗੇ ਫੋਟੋ ਨੂੰ ਕੋਈ ਫੈਕਸਿਲ ਨਹੀਂ ਪਾਟੂਗਾ ਇਸ ਤਰ੍ਹਾਂ ਦੇ ਕੈਮਰੇ ਨੇ ਵੀ ਅੱਗੇ ਨਾਲੋਂ ਜਿਹੜੀ ਹੈਗੀ ਆ ਕੈਮਰਿਆਂ ਦੀ ਕੰਪੈਸਟੀ ਆ ਜਾਂ ਕੈਮਰਿਆਂ ਉਹ ਲਾ ਲਓ ਵੀ ਡਿਜੀਟਲ ਕੈਮਰੇ ਨੇ ਵਧੀਆ ਕੈਮਰੇ ਨੇ ਗੇ ਅਤੇ ਇਹੀ ਵੀ ਪੁਰਾਣੀਆਂ ਫੋਟੋਆਂ ਨਾਲੋਂ ਜਿਵੇਂ ਹੈਗਾ ਨਵੀਂ ਫੋਟੋਆਂ ਦੇ ਨੇ ਉਹ ਕਾਫੀ ਭਾਵਨਿਕ ਮੁੱਲ 'ਤੇ ਹੈ ਹੈ ਨਾ ਕਾਫੀ ਉਹ ਅਲੱਗ ਨੇ ਅਤੇ ਇਸ ਤਰ੍ਹਾਂ ਨੇ